ਕੁਝ ਸਿਹਤਮੰਦ ਪਕਵਾਨ ਤੁਹਾਨੂੰ ਪਤਾ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਬੱਚੇ ਤੋਂ ਲੈ ਕੇ ਬੁੱਢੇ ਨੂੰ ਵੀ ਪਸੰਦ ਹੈ ਕਿਉਂ ਕਿਉਂਕਿ ਹਰੀਆਂ ਚੀਜ਼ਾਂ ਸਾਡੀਆਂ ਅੱਖਾਂ ਦੀ ਰੋਸ਼ਨੀ ਵਧਾਉਂਦੀਆਂ ਨੇ ਇਹਦੇ ਵਿੱਚ ਹਰੀ ਪਾਲਕ ਕਿੰਨੀ ਸਿਹਤ ਲਈ ਸਿਹਤਮੰਦ ਹੈ ਫਿਰ ਜਿਹੜੇ ਬੱਚੇ ਮੱਖਣ ਨਹੀਂ ਖਾਂਦੇ ਅਤੇ ਸਰ੍ਹੋਂ ਦੀ ਸੋ ਓ ਸਰ੍ਹੋਂ ਦੇ ਸਾਗ ਦੇ ਵਿੱਚ ਮੱਖਣ ਪੈ ਜਾਂਦਾ ਅਤੇ ਰੋਟੀ 'ਤੇ ਵੀ ਮੱਖਣ ਪੈ ਜਾਂਦਾ ਹੁਣ ਆ ਗਈ ਗੱਲ ਜੇ ਅਸੀਂ ਸਿੰਪਲ ਚੀਜ਼ਾਂ ਦੇਖੀਏ ਤਾਂ ਵੇਸਣ ਦਾ ਪੂੜਾ ਐਡਾ ਸਵਾਦ ਬਣਦਾ ਸਾਡੇ ਸ਼ੂਗਰ ਲੈਵਲ ਵਾਸਤੇ ਸ਼ੂਗਰ ਵਾਲੇ ਬੰਦਿਆਂ ਵਾਸਤੇ ਵੀ ਬਹੁਤ ਵਧੀਆ ਇੰਨੇ ਕੁ ਸਾਡੀ ਸਿਹਤ ਸਹੀ ਰੱਖਦਾ ਕੋਈ ਕਹਿਣ ਦੀ ਗੱਲ ਨਹੀਂ ਹੁਣ ਜਿਵੇਂ ਕਈ ਵਾਰੀ ਸਾਨੂੰ ਸਾਡੇ ਬਹੁਤ ਥੱਕੀਆਂ ਟੁੱਟੀਆਂ ਹੁੰਦੀਆਂ ਅਸੀਂ ਕਹਿੰਦੇ ਹਾਂ ਹਾਏ ਸੌਖਾ ਕੰਮ ਕੀ ਕਰੀਏ ਅਸੀਂ ਕੀ ਕਰਦੇ ਹਾਂ ਮਟਰ ਛਿਲਦੇ ਹਾਂ ਚਾਵਲਾਂ ਨੂੰ ਧੋਨੇ ਹਾਂ ਉਹਦੇ ਵਿੱਚ ਅਸੀਂ ਕੀ ਕਰਦੇ ਹਾਂ ਥੋੜ੍ਹਾ ਜਿਹਾ ਘਿਓ ਪਾਉਂਦੇ ਹਾਂ ਕਿਸ ਘਿਓ ਪਾ ਲਓ ਚਾਹੇ ਤੁਸੀਂ ਤੇਲ ਪਾ ਲਓ ਵਿੱਚ ਜ਼ੀਰਾ ਪਾਓ ਕਾਲੀ ਮਿਰਚ ਪਾਓ ਲੂਣ ਪਾਓ ਉਹਦੇ ਵਿੱਚ ਤੁਸੀਂ ਕੋਈ ਵੀ ਗਾਜਰਾਂ ਪਾ ਲਓ ਮਟਰ ਪਾ ਲਓ ਫੇਰ ਤੁਸੀਂ ਅ ਫਲੀਆਂ ਪਾ ਲਓ ਗੋਭੀ ਪਾ ਲਓ ਆਲੂ ਪਾ ਲਓ ਪਾ ਕੇ ਤੁਸੀਂ ਮਟਰਾਂ ਵਾਲੇ ਚੌਲ ਬਣਾ ਸਕਦੇ ਹੋ ਬਰਿਆਨੀ ਵਾਲੇ ਚਾਵਲ ਬਣਾ ਸਕਦੇ ਹੋ ਠੀਕ ਹੈ ਨਾ ਅਤੇ ਜੇ ਤੁਸੀਂ ਪਰੌਂਠਿਆਂ ਦੀ ਗੱਲ ਆ ਜੋ ਤਾਂ ਪਰੌਂਠਿਆਂ ਦੇ ਵਿੱਚ ਆਲੂ ਵਾਲੇ ਪਰੌਂਠੇ ਨਾਲ ਤੁਸੀਂ ਮਜ਼ੇ ਨਾਲ ਉੱਤੇ ਰੱਖੋ ਘਿਓ ਮੱਖਣ ਘਿਓ ਦੇਸੀ ਨਾਲ ਲਵੋ ਦਹੀਂ ਅਤੇ ਲੈ ਬਹਿ ਜਾ ਬਹਿ ਜਾ ਹੋ ਜਾਂਦੀ ਹੈ ਨਾਲ ਤੁਸੀਂ ਖਾਓ ਗੋਭੀ ਵਾਲੇ ਪਰੌਂਠੇ ਜਿਹੜੇ ਕਿ ਢਿੱਡ ਭਰ ਭਰ ਕੇ ਖਾਧੇ ਜਾਂਦੇ ਮੂਲੀ ਵਾਲੇ ਪਰੌਂਠੇ ਜੇ ਸਾਡੇ ਪੈਰ ਤੁਹਾਡੇ ਹੋਈ ਗੈਸ ਦੀ ਪ੍ਰੋਬਲਮ ਤਾਂ ਗੈਸ ਹੀ ਨਿਕਲ ਜਾਂਦੀ ਉਹਦੇ ਨਾਲ ਉਸ ਤੋਂ ਬਾਅਦ ਤੁਸੀਂ ਅਗਰ ਦੁਪਹਿਰ ਦਾ ਖਾਣਾ ਦੇਖ ਲਉ ਕਦੀ ਮਨਚੂਰੀਅਨ ਬਣਾ ਲਉ ਮਿਕਸ ਵੈਜੀਟੇਬਲ ਬਣਾ ਲਉ ਹਰੀਆਂ ਸਬਜ਼ੀਆਂ ਨੇ ਬੜੀਆਂ ਤਾਕਤਵਾਰ ਨੇ ਮਨਚੂਰੀਅਨ ਬਣਾ ਲਉ ਭੈਣ ਜੀ ਮੱਖਣੀ ਦਾਲ ਬਣਾ ਕੇ ਵਿੱਚ ਮੱਖਣ ਸੁੱਟ ਦਿਉ ਘਿਓ ਸੁੱਟ ਦਿਉ ਕਿਤੇ ਮਜ਼ਾ ਆਉਂਦਾ ਜੇ ਨਾਲ ਹੋਣ ਨਾਨ ਤਾਂ ਮਜਾ ਹੀ ਆ ਜੇ ਉਸ ਤੋਂ ਬਾਅਦ ਤੁਸੀਂ ਜੇ ਆਪਾਂ ਕਹੀਏ ਕਿ ਅਸੀਂ ਚਿੱਟੇ ਛੋਲੇ ਬਣਾ ਲਈਏ ਨਾਲ ਰਾਜਮਾਂਹ ਚਾਵਲ ਜਾਂ ਚਾਵਲ ਅਤੇ ਚਿੱਟੇ ਛੋਲੇ ਬਣ ਜਾਣ ਉਹ ਵੀ ਵਧੀਆ ਲੱਗਦੇ ਆ ਭਟੂਰੇ ਛੋਲੇ ਵੀ ਵਧੀਆ ਲੱਗਦੇ ਆ ਪੂੜੀ ਛੋਲੇ ਵੀ ਵਧੀਆ ਲੱਗਦੇ ਆ ਕਹਿੰਦੇ ਜਦੋਂ ਅਸੀਂ ਆਹ ਸਾਰਾ ਸਮਾਨ ਬਣਾ ਲੈਂਦੇ ਹਾਂ ਨਾ ਪੁਲਾਵ ਬਣਾ ਲੈਂਦੇ ਹਾਂ ਪਾਓ ਭਾਜ਼ੀ ਬਣਾ ਲੈਂਦੇ ਹਾਂ ਬੜਾ ਇਡਲੀ ਬੜਾ ਸਾਂਬਰ ਬਣਾ ਲੈਂਦੇ ਹਾਂ ਆਲੂ ਰੋਲ ਬਣਾ ਲੈਂਦੇ ਹਾਂ ਡੋਗ ਡੋਗਾ ਸਾਂਬਰ ਬਣਾ ਲੈਂਦੇ ਹਾਂ ਫਿਰ ਹੈਲਥੀ ਪੀਜ਼ਾ ਬਣਾ ਲੈਂਦੇ ਹਾਂ ਅਸੀਂ ਕਿੰਨੀਆਂ ਹੀ ਚੀਜ਼ਾਂ ਬਣਾ ਲੈਂਦੇ ਹਾਂ ਉਸ ਤੋਂ ਬਾਅਦ ਅਸੀਂ ਕਈ ਵਾਰੀ ਕੀ ਕਰਦੇ ਅਸੀਂ ਜ਼ਿਆਦਾ ਖਾ ਲਿਆ ਵਾ ਹੁਣ ਅਸੀਂ ਇਹਨੂੰ ਪਚਾਉਣਾ ਵੀ ਆਂ ਉਹਦੇ ਲਈ ਅਸੀਂ ਕਰਦੇ ਦੁੱਧ ਵਿੱਚ ਦੁੱਧ ਨੂੰ ਕਾੜ ਲੈਂਦੇ ਹਾਂ ਥੋੜ੍ਹਾ ਪਾਉਂਦੇ ਉਹਦੇ 'ਚ ਮਿੱਠਾ ਅਤੇ ਉਹਦੇ 'ਚ ਪਾਉਂਦੇ ਹਲਦੀ ਹਲਦੀ ਪਵਾ ਕੇ ਕਿਤੇ ਮੈਂ ਕਹਿੰਦੀ ਦੁੱਧ ਪੀ ਕੇ ਤਾਂ ਦੇਖੋ ਤੁਹਾਡੀਆਂ ਹੱਡੀਆਂ ਬਿਲਕੁਲ ਸਹੀ ਹੋ ਜਾਣਗੀਆਂ ਸਰੀਰ ਤੰਦਰੁਸਤ ਹੋਜੂ ਸਾਨੂੰ ਕੋਈ ਖਾਂਸੀ ਬਲਗਮ ਇਹੋ ਜਿਹੀ ਕੋਈ ਪ੍ਰੋਬਲਮ ਹੋਵੇ ਨਾ ਤਾਂ ਇਸ ਦੁੱਧ ਨਾਲ ਤਾਂ ਉਹ ਵੀ ਹੱਲ ਹੋ ਜਾਂਦਾ ਵਾ ਕਹਿੰਦੇ ਗੋਲਗੱਪੇ ਹਾਏ ਇਹ ਤਾਂ ਸਾਰਿਆਂ ਦੀ ਪਸੰਦ ਆ ਰੋਟੀ ਖਾਣ ਤੋਂ ਬਾਅਦ ਕਿਤੇ ਗੋਲਗੱਪੇ ਅਤੇ ਪੁਦੀਨੇ ਵਾਲੀ ਚਟਨੀ ਦੀ ਕਾਂਜੀ ਹੋਵੇ ਤਾਂ ਮੈਂ ਕਹਿੰਦੀ ਬਹਿ ਜਾ ਬਹਿ ਜਾ ਹੀ ਹੋ ਜੇ ਇਹ ਚੀਜ਼ਾਂ ਅਸੀਂ ਹਰ ਰੋਜ਼ ਦੇ ਖਾਣੇ ਵਿੱਚ ਬਦਲ ਬਦਲ ਕੇ ਬਣਾਉਂਦੇ ਹਾਂ ਕਿ ਪਰਿਵਾਰ ਨੂੰ ਸੋਹਣੀਆਂ ਸੋਹਣੀਆਂ ਚੀਜ਼ਾਂ ਤਿਆਰ ਕਰਕੇ ਉਹਨਾਂ ਨੂੰ ਖਵਾਈਏ ਤਾਂ ਜੋ ਉਹ ਵੀ ਖੁਸ਼ ਅਤੇ ਅਸੀਂ ਵੀ ਖੁਸ਼ ਕਹਿੰਦੇ ਸੁਖੀ ਪਰਿਵਾਰ